ਸਿੱਖ ਇਤਿਹਾਸ ਅਤੇ ਪੰਜਾਬ ਦਾ ਸਿੱਖ ਇਤਿਹਾਸ ਸਿੱਖਾਂ ਨਾਲ ਸੰਬੰਧਿਤ ਪਰਿਵਾਰਿਕ ਕਹਾਣੀਆਂ ਨਾਲ ਭਰਿਆ ਪਿਆ ਹੈ ਜਿਸ ਦਾ ਮੁੱਖ ਯੋਗਦਾਨ ਮਹਾਰਾਜਾ ਰਣਜੀਤ ਸਿੰਘ ਦੇ ਦੇ ਪਿਤਾ ਦੇ ਨਾਲ ਸੰਬੰਧਿਤ ਸ਼ੁਰੂ ਹੋਇਆ ਹੈ ਮਹਾਰਾਜਾ ਦਾ ਰਣਜੀਤ ਸਿੰਘ ਦੇ ਪਿਤਾ ਬਹੁਤ ਹੀ ਬਹਾਦਰੀ ਵਾਲੇ ਇਨਸਾਨ ਸਨ ਜਿਸ ਕਾਰਨ ਮਹਾਰਾਜਾ ਰਣਜੀਤ ਵੀ ਇੱਕ ਬਹਾਦਰੀ ਅਤੇ ਕਾਇਮ ਯੋਧਾ ਬਣੇ ਅੱਠ ਸਾਲ ਦੀ ਉਮਰ ਵਿੱਚ ਉਸ ਨੇ ਪੂਰੇ ਅੱਠ ਸਾਲ ਦੀ ਉਮਰ ਵਿੱਚ ਉਸਨੇ ਨਿੱਕੀ ਜਿਹੀ ਇੰਨੀ ਛੋਟੀ ਉਮਰ ਦੇ ਵਿੱਚ ਉਸਨੇ ਇਨਾ ਵੱਡਾ ਯੋਗਦਾਨ ਦਿੱਤਾ ਕਿ ਉਹ ਇਤਿਹਾਸ ਵਿੱਚ ਲਿਖਿਆ ਗਿਆ ਉਸਨੇ ਸਾਰੀਆਂ ਮਿਸਲਾਂ ਨੂੰ ਇਕੱਠੇ ਕਾਇਮ ਕੀਤਾ ਉਸ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ ਉਹਨਾਂ ਨੂੰ ਕਾਇਮ ਕੀਤਾ ਮਿਸਲਾਂ ਨੂੰ ਅਤੇ ਇੱਕ ਅਨੋਖੀ ਰੀਤ ਚਲਾਈ ਜਿਸ ਵਿੱਚ ਸਿੱਖ ਇਤਿਹਾਸ ਵਿੱਚ ਰਾਜ ਬੜਾ ਸੁਚੱਜੇ ਢੰਗ ਨਾਲ ਚੱਲਣ ਲੱਗਾ ਮਹਾਰਾਜਾ ਰਣਜੀਤ ਸੀ ਸਿੰਘ ਨੇ ਪਹਿਲਾਂ ਸਾਰੀਆਂ ਮਿਸਲਾਂ ਨੂੰ ਇਕੱਠਾ ਕੀਤਾ ਫਿਰ ਇੱਕ ਵੱਡੇ ਰਾਜ ਦੇ ਰੂਪ ਵਿੱਚ ਕਾਇਮ ਕੀਤਾ ਅਤੇ ਸਭ ਤੋਂ ਵੱਡਾ ਰਾਜ ਸ਼ਾਮਲ ਹੋ ਗਿਆ ਅਤੇ ਸਭ ਤੋਂ ਵੱਡਾ ਰਾਜ ਵੀ ਬਣ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦੁਸ਼ਮਣਾਂ ਨਾਲ ਟੱਕਰ ਨਾਲ ਟੱਕਰ ਲਈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਧੀਆ ਕੁਸ਼ਲ ਰਾਜ ਸਥਾਪਤ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਹਰੇਕ ਪਰਜਾ ਦਾ ਦੁੱਖ ਸੁੱਖ ਵੰਡਾਉਂਦੇ ਸਨ ਅਤੇ ਅਤੇ ਆਪਣੀ ਪਰਜਾ ਦੇ ਕੰਮਾਂ ਦੀ ਜਾਂਚ ਪੜਤਾਲ ਵੀ ਕਰਦੇ ਸਨ ਉਹ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕੰਮ ਦਾ ਜਾਇਜ਼ਾ ਲੈਣ ਲਈ ਪਰਜਾ ਵਿੱਚ ਭੇਸ਼ ਬਦਲ ਕੇ ਜਾਂਦੇ ਸਨ ਇਸ ਕਾਰਨ ਇਹਨਾਂ ਪਰਜਾ ਨੂੰ ਉਹਨਾਂ ਦੇ ਰਾਜ ਦਾ ਵਿਸਥਾਰ ਬਹੁਤ ਹੀ ਵਧੀਆ ਲਗਦਾ ਸੀ ਸਿੱਖ ਇਤਿਹਾਸ ਵਿੱਚ ਕਹਾਣੀਆਂ ਬੜੀਆਂ ਲੰਬੀਆਂ ਹਨ ਪ੍ਰੰਤੂ ਜਿਹਨਾਂ ਦਾ ਜਿਕਰ ਅਸੀਂ ਬੋਲਦੇ ਥੱਕ ਨਹੀਂ ਸਕਦੇ ਅਤੇ ਨਾ ਹੀ ਜਿਕਰ ਅਸੀਂ ਕਰ ਸਕਦੇ ਹਾਂ ਮਾਹ ਦਲੀਪ ਸਿੰਘ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਰਹੇ ਉਹਨਾਂ ਨੇ ਵੀ ਬੜੇ ਸੁਚੱਜੇ ਢੰਗ ਨਾਲ ਪ੍ਰਸ਼ਾਸਨ ਨੂੰ ਚਲਾਇਆ ਪਰ ਅਣਜਾਣ ਮਹਾਤਮਾ ਅਤੇ ਕੁਝ ਗੱਦਾਰ ਲੋਕਾਂ ਨੇ ਉਹਨਾਂ ਦੇ ਪ੍ਰਸ਼ਾਸਨ ਨੂੰ ਚਲਾਉਣ ਵਿੱਚ ਆ ਸਭ ਵਿੱਚ ਵਿਘਨ ਪਾਇਆ ਜਿਸ ਕਾਰਨ ਉਹ ਹਕੁਮਤ ਪਿੱਛੇ ਹਟਣ ਲੱਗ ਗਈ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਵਿਕਟੋਰੀਆ ਇੰਗਲੈਂਡ ਵਿੱਚ ਵਿੱਚ ਲਿਆਉਂਦਾ ਗਿਆ ਅਤੇ ਉਹ ਹਾਰ ਗਏ ਮਹਾਰਾਜਾ ਦਲੀਪ ਸਿੰਘ ਬੜੇ ਸੁ ਸੁਚੱਜੇ ਅਤੇ ਬਹੁਤ ਵਧੀਆ ਪ੍ਰਸ਼ਾਸਨ ਸੰਚਾਲਕ ਸਨ ਜੋ ਕਿ ਉਸ ਨੂੰ ਇੰਗਲੈਂਡ ਲੈ ਕੇ ਗਿਆ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਦਲੀਪ ਨੇ ਉਹਨੂੰ ਉਸ ਨੂੰ ਸਮਝਾਇਆ ਕਿ ਤੂੰ ਇਹਨਾਂ ਦੀ ਬੰਦਿਸ਼ਾਂ ਜੇਲ੍ਹਾਂ ਵਿੱਚ ਕੱਟ ਰਿਹਾ ਹੈ ਤੂੰ ਇੱਕ ਰਾਜਾ ਹੈ ਤਾਂ ਫਿਰ ਉਹਨਾਂ ਦੇ ਸਮਝਾਉਣ ਦੇ ਨਾਲ ਇੰਨਾ ਪ੍ਰਭਾਵ ਪਿਆ ਕਿ ਉਹ ਇੱਕ ਵਧੀਆ ਪ੍ਰਸ਼ਾਸਨ ਅਤੇ ਸੁਚਲ ਉਹ ਇੱਕ ਵਧੀਆ ਪ੍ਰਸ਼ਾਸਨ ਅਤੇ ਸਚਚ ਸੰਚਾਲਨ ਦੇ ਲਈ ਫਿਰ ਤੋਂ ਤਿਆਰ ਹੋ ਗਏ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਰਾਜੇ ਹਨ ਪਰ ਗੱਦਾਰ ਲੋਕਾਂ ਨੇ ਇਹਨਾਂ ਨੀਤੀਆਂ ਦੇ ਕਾਰਨ ਸਿੱਖ ਸਿੱਖ ਗੱਦਾਰ ਲੋਕਾਂ ਦੀਆਂ ਇਹਨਾਂ ਨੀਤੀਆਂ ਦੇ ਕਾਰਨ ਸਿੱਖ ਸਿੱਖ ਲੋਕਾਂ ਵਿੱਚ ਵਿੱਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਪੈਦਾ ਕੀਤੀ ਇਹ ਕਹਾਣੀਆਂ ਸਿੱਖ ਧਰਮ ਵਿੱਚ ਪੀੜ੍ਹੀ ਤੋਂ ਪੀੜ੍ਹੀ ਕਹਾਣੀਆਂ ਚੱਲਦੀਆਂ ਰਹਿਣੀਆਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਤੋਂ ਸਟਾਰਟ ਹੋਈ ਫਿਰ ਮਹਾਰਾਜਾ ਰਣਜੀਤ ਸਿੰਘ ਤੋਂ ਹੋਈ ਅਤੇ ਦਲੀਪ ਸਿੰਘ ਤੋਂ ਦਲੀਪ ਸਿੰਘ ਤੋਂ ਬਾਅਦ ਹੋਰ ਵੀ ਬਹੁਤ ਯੋਧੇ ਹੋਏ ਹਨ ਜਿਹਨਾਂ ਨੇ ਸਿੱਖ ਇਤਿਹਾਸ ਵਿੱਚ ਕਹਾਣੀਆਂ ਅਤੇ ਨਵੀਂ ਸੇਧ ਦਿੱਤੀ ਅਤੇ ਆਉਣ ਵਾਲੀ ਪੀੜ੍ਹੀ ਦੇ ਲਈ ਇੱਕ ਵਧੀਆ ਰੋਜ ਮੋਡਲ ਦਾ ਕੰਮ ਕੀਤਾ